ਵਿਆਹ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਅਸੀਂ ਪਾਣੀ ਦਾ ਪ੍ਰਬੰਧ ਕਰਨ ਲਈ ਟੈਂਕਰ ਮੰਗਵਾਉਂਦੇ ਹਾਂ ਕਈ ਤਰ੍ਹਾਂ ਦੇ ਗਿਲਾਸ ਛੋਟੇ ਗਿਲਾਸ ਵੱਡੇ ਗਿਲਾਸ ਸਭ ਤਰ੍ਹਾਂ ਦੀਆਂ ਚੀਜ਼ਾਂ ਮੰਗਵਾਉਂਦੇ ਹਾਂ ਬੱਚਿਆਂ ਨੂੰ ਅਸੀਂ ਛੋਟੇ ਗਲਾਸ ਦਿੰਦੇ ਹਾਂ ਤਾਂ ਕਿ ਪਾਣੀ ਦੀ ਵੇਸਟੇਜ਼ ਨਾ ਹੋਵੇ ਪਾਣੀ ਦੀ ਵਰਤੋਂ ਚਾ ਚੰਗੀ ਤਰ੍ਹਾਂ ਨਾਲ ਕੀਤੀ ਜਾਵੇ ਔਰ ਅਸੀਂ ਆਪਣੇ ਘਰ ਦੇ ਵਿੱਚ ਵੀ ਟੈਂਕੀਆਂ ਭਰ ਕੇ ਰੱਖੀਦੀਆਂ ਨੇ ਕਿ ਕਿਸੇ ਵੇਲੇ ਵੀ ਲਾਈਟ ਜਾ ਸਕਦੀ ਹੈ ਅਤੇ ਪਾਣੀ ਦੀ ਜ਼ਰੂਰਤ ਪੈ ਸਕਦੀ ਹੈ ਅਤੇ ਟੈਂਕਰ ਵੀ ਮੰਗਵਾ ਲਈਦੇ ਨੇ ਵਿਆਹਵਾਂ ਵਿੱਚ ਆਪਾਂ ਛੋਟੇ ਗਲਾਸ ਵੱਡੇ ਗਲਾਸ ਬੋਤਲਾਂ ਸਭ ਮੰਗਵਾ ਕੇ ਰੱਖੀਦੀਆਂ ਕਿਉਂਕਿ ਬੱਚੇ ਛੋਟੇ ਗਲਾਸਾਂ ਵਿੱਚ ਪਾਣੀ ਪੀਣ ਅਤੇ ਆਪਣੀ ਵੇਸਟੇਜ਼ ਨਾ ਕਰਨ ਅਤੇ ਅਸੀਂ ਵੈਸੇ ਵੀ ਆਪਣੇ ਘਰ ਦੀਆਂ ਸਾਰਾ ਟੈਂਕੀਆਂ ਟੁੰਕੀਆਂ ਫੁੱਲ ਕਰਕੇ ਰੱਖੀਦੀਆਂ ਔਰ ਮੈਨੂੰ ਲੱਗਦਾ ਹੈ ਕਿ ਪਾਣੀ ਦੀ ਵਰਤੋਂ ਬੜੇ ਸੰਭਾਲ ਕੇ ਕਰਨੀ ਚਾਹੀਦੀ ਹੈ ਤਾਂ ਕੀ ਉਹਦੀ ਵੇਸਟੇਜ਼ ਨਾ ਹੋ ਸਕੇ ਆਉਣ ਵਾਲੇ ਸਮੇਂ ਵਿੱਚ ਸਾਨੂੰ ਪਾਣੀ ਦੀ ਕਮੀ ਮਹਿਸੂਸ ਹੋ ਜਾਏਗੀ ਤਾਂ ਕਿ ਸਾਰੇ ਜਾਣੇ ਪਾਣੀ ਨੂੰ ਵਰਤਣ ਨਹਾਉਣ ਵੇਲੇ ਵੀ ਅਸੀਂ ਆਪਣੇ ਪਾਣੀ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਤਾਂ ਕਿ ਵੇਸਟੇਜ਼ ਨਹੀਂ ਹੋਣੀ ਚਾਹੀਦੀ ਆਪਣੀ ਰਸੋਈ ਦੇ ਕੰਮਾਂ ਵਿੱਚ ਵੀ ਅਤੇ ਇਸ ਲਈ ਵਿਆਹ ਦੇ ਦਿਨਾਂ ਦੇ ਵਿੱਚ ਤਾਂ ਪਾਣੀ ਦੀ ਵਰਤੋਂ ਬਹੁਤ ਘੱਟ ਆਪਣੇ ਘਰ ਦੇ ਵਿੱਚ ਕਰੋ ਤਾਂ ਕਿ ਜਿਹਨਾਂ ਦਿਨਾਂ 'ਚ ਵਿਆਹ ਹੈਗਾ ਵੈ ਉਹਨਾਂ ਦੇ ਨਾਲ ਸਾਨੂੰ ਪਾਣੀ ਦੀ ਜ਼ਰੂਰਤ ਪੈ ਸਕਦੀ ਹੈ